ਹੈਲੋ ਹਾਂਜੀ ਕਿਵੇਂ ਆ ਮੈਂ ਕੀਤਾ ਸੀ ਮੈਂ ਕਹਿੰਦੀ ਸੀ ਵੀ ਇੱਕ ਤਾਂ ਆਪਣਾ ਸਿਲੰਡਰ ਖਤਮ ਹੋ ਗਿਆ ਨਹੀਂ ਨਹੀਂ ਉਹ ਨਾ ਖਤਮ ਹੋ ਗਿਆ ਸੀਗਾ ਮੈਂ ਕਿਹਾ ਫਿਰ ਕੱਲ੍ਹ ਫਿਰ ਮਿਲਣਾ ਨਹੀਂ ਜੇ ਹੁਣ ਪੁੱਛਦੀ ਹਾਂ ਮੈਂ ਫਿਰ ਉਹਨਾਂ ਨੂੰ ਵੀ ਚਾਹੀਦਾ ਹੋਊ ਉਹਨਾਂ ਨੂੰ ਵਾਪਿਸ ਵੀ ਕਰਨਾ ਪਊਗਾ ਹਾਂ ਨਹੀ ਨਹੀਂ ਕੋਈ ਨਹੀਂ ਮੈਂ ਫੜ ਲੈਂਦੀ ਠੀਕ ਹੈ ਅਤੇ ਹੋਰ ਨਾਲੇ ਬਾਜ਼ਾਰ ਜਾਣਾ ਸੀਗਾ ਹੁੰ ਬਜ਼ਾਰੋਂ ਇਕ ਤਾਂ ਉਹ ਕੱਪੜੇ ਲਿਆਉਣੇ ਸੀ ਬੱਚਿਆਂ ਦੇ ਉਹ ਕਹਿੰਦੇ ਸੀਗੇ ਕੱਪੜੇ ਸ਼ੂਜ ਸ਼ਾਜ ਵੀ ਹੈ ਨਹੀਂ ਸਰਦੀ ਵਾਲੇ ਹਾਂ ਤੇ ਕੱਪੜੇ ਅਤੇ ਇੱਕ ਉਹ ਬੁਕਸ ਵਗੈਰਾ ਵੇਖਣੀਆਂ ਸੀ ਉਹ ਵੀ ਲਿਆਉਣੀਆਂ ਹਾਂ ਹਾਂਜੀ ਹੁੰ ਹੋਰ ਇੱਕ ਸੌਦਾ ਵੀ ਲਿਆਉਣ ਵਾਲਾ ਸੀਗਾ ਸਮਾਨ ਮੁੱਕਿਆ ਪਿਆ ਹੁੰ ਹੁੰ ਹੁੰ ਹਾਂ ਜੀ ਇਹ ਤਾਂ ਹੈਗਾ ਕੋਈ ਗੱਲ ਨਹੀਂ ਹਾਂ ਰਸ਼ ਤਾਂ ਹੈਗਾ ਉਹ ਹੀ ਤਾਂ ਗੱਲ ਹੈ ਇਕ ਮੌਸਮ ਵੀ ਬਾਹਲਾ ਖ਼ਰਾਬ ਜਿਹਾ ਹੋਇਆ ਪਿਆ ਹੁੰ ਹੁੰ ਹੁੰ ਹੁੰ ਹੁੰ ਹਾਂ ਉਸ ਤੋ ਹਾਂਜੀ ਬਸ ਮੈਂ ਲਿਸਟ ਬਣਾਉਂਣੀ ਹਾਂਜੀ ਹਾਂਜੀ ਹਾਂਜੀ ਨਾਲੇ ਮੈਂ ਐਂ ਆ ਨਾ ਦਾਲ ਸਬਜ਼ੀ ਫਿਰ ਬਣਾ ਲੈਣੀ ਆ ਆਟਾ ਊਟਾ ਗੁੰਨ ਦੂੰਗੀ ਹਾਂ ਫੇ ਹਾਂ ਫੇ ਫਿਰ ਆ ਹਾਂ ਹੋਰ ਆ ਕੇ ਫੁਲਕੇ ਲਾਹ ਲਾਂਗੇ ਹਾਂਜੀ ਹਾਂ ਮੈਂ ਸਬਜ਼ੀ ਬਣਾ ਕੇ ਰੱਖ ਲਈ ਅਤੇ ਇੱਕ ਸਬਜ਼ੀਆਂ ਸੁਬਜ਼ੀਆਂ ਵੀ ਲੈ ਆਵਾਂਗੇ ਫਿਰ ਪਿਆਜ਼ ਪਿਉਜ ਆਲੂ ਉਲੂ ਵੀ ਹਾਂ ਹੁੰ ਖਤਮ ਹੋਏ ਪਏ ਆ ਨਾ ਫਿਰ ਕਾਫ਼ੀ ਹੁਣ ਚੱਲ ਹਫਤਾ ਤਾਂ ਨਿਕਲ ਹੀ ਜਾਂਦਾ ਸਬਜ਼ੀਆਂ ਹਾਂ ਤੇ ਰੋਜ਼ ਰੋਜ਼ ਲਿਆਉਣ ਨਾਲੋਂ ਹਾਂ ਹਾਂ ਵਾਰ ਵਾਰ ਨਹੀਂ ਜਾਇਆ ਜਾਂਦਾ ਫਿਰ ਚਲੋ ਫਿਰ ਅਸੀਂ ਨਾ ਮੈਂ ਕਹਿੰਦੀ ਸੀ ਕਿ ਟਾਈਮ ਨਾਲ ਹੀ ਆਪਾਂ ਜਾ ਆਉਂਦੇ ਹਾਂਜੀ ਹਾਂ ਨਹੀਂ ਕੋਈ ਨਹੀਂ ਟਾਈਮ ਨਾਲ ਹੀ ਫਿਰ ਜਾ ਆਵਾਂਗੇ ਠੀਕ ਠੀਕ ਠੀਕ ਹੈ ਚੰਗਾ ਆ ਜਾਓ ਤੁਸੀਂ ਠੀਕ ਹੈ ਠੀਕ ਹੈ ਜੀ ਓਕੇ